ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਬਲਵੰਤ ਰਾਜ ਪਿੰਡ ਫਿਰੋਜ਼ਪੁਰ ਕਲਾਂ ਤੋਂ ਬੋਲ ਰਿਹਾ ਜੀ ਮੈਂ ਤੁਹਾਡੀ ਕੈਬ ਅੰਬਰਸਰ ਜਾਣ ਵਾਸਤੇ ਓਲਾ ਕੈਬ ਬੁੱਕ ਕਰਵਾਈ ਸੀਗੀ ਅਤੇ ਜਿਸ ਰਸਤੇ ਤੁਸੀਂ ਸਰ ਆਉਣਾ ਹੈ ਉਹ ਰਸਤਾ ਥੋੜ੍ਹਾ ਕੰਟਰਕਸ਼ਨ ਕਰਕੇ ਖਰਾਬ ਹੈ ਅਤੇ ਤੁਸੀਂ ਕਿੰਨੇ ਮੈਂ ਸਾਢੇ ਸੱਤ ਵਜੇ ਦੇ ਨ ਨੇੜੇ ਤੇੜੇ ਮੈਨੂੰ ਚਾਹੀਦਾ ਬਈ ਮੈਂ ਤੁਹਾਡੀ ਕੈਬ ਹਾਇਰ ਕਰਾਂ ਅਤੇ ਤੁਸੀਂ ਕਿੰਨੇ ਵਜੇ ਨਿਕਲੋਗੇ ਅਤੇ ਮੇਰੇ ਤੱਕ ਪਹੁੰਚ ਜਾਓਗੇ ਕ੍ਰਿਪਾ ਕਰਕੇ ਤੁਸੀਂ ਸਹੀ ਟੈਮ ਨਾਲ ਨਿਕਲਿਓ ਤਾਂ ਜੋ ਮੈਂ ਮੈਨੂੰ ਉੱਥੇ ਸ਼ਾਦੀ ਦਾ ਫੰਕਸ਼ਨ ਅਟੈਂਡ ਕਰਨਾ ਹੈ ਤਾਂ ਜੋ ਮੈਂ ਟੈਮ 'ਤੇ ਪਹੁੰਚ ਜਾਵਾਂ ਅਤੇ ਮੈਨੂੰ ਕੋਈ ਹਰਾਸਮੈਂਟ ਨਾ ਹੋਵੇ ਅਤੇ ਮੈਂ ਬਾਕੀ ਮੇਰਾ ਪਰਿਵਾਰ ਵੀ ਨਾਲ ਜਾਣਾ ਹੈ ਅਤੇ ਤੁਸੀਂ ਪਲੀਜ ਥੋੜ੍ਹਾ ਜਲਦੀ ਨਿਕਲ ਆਓ ਅਤੇ ਨਾਲੇ ਪੈਸੇ ਦੇ ਬਾਰੇ 'ਚ ਵੀ ਥੋੜ੍ਹਾ ਦੱਸ ਦਿੰਦੇ ਬਈ ਕਿੰਨੇ ਪੈਸੇ ਸੀ ਤੁਹਾਡੇ ਅੰਬਰਸਰ ਦਾ ਕਿਰਾਇਆ ਚਾਰਜ ਕਿੰਨਾ ਹੈ ਅਤੇ ਮੈਨੂੰ ਤੁਸੀਂ ਕ ਕਾਲ ਕਾਲ ਕਰੋ ਅਤੇ ਮੈਂ ਤੁਹਾਡੇ ਕਾਲ ਦਾ ਇੰਤਜ਼ਾਰ ਕਰਿਆ ਕਰਦਾ ਅਤੇ